ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਜੇ ਤੁਹਾਨੂੰ ਸਾਡੇ 'ਤੇ ਪੂਰਾ ਵਿਸ਼ਵਾਸ ਹੈ ਤਾਂ ਤੁਸੀਂ ਸਾਡੇ ਨਾਲ ਆਪਣੇ ਬੱਚੇ ਨੂੰ ਭੇਜ ਸਕਦੇ ਹੋ ਠੀਕ ਹੈ ਅਤੇ ਅਸੀਂ ਤੁਹਾਡੇ ਬੱਚੇ ਨੂੰ ਸ਼੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਸਾਹਿਬ 'ਚ ਲਿਜਾ ਕੇ ਉਹਨਾਂ ਨੂੰ ਉੱਥੋਂ ਦੇ ਇਤਿਹਾਸ ਬਾਰੇ ਦੱਸਾਂਗੇ ਅਤੇ ਉਹਨਾਂ ਨੂੰ ਹੋਰ ਦੱਸਾਂਗੇ ਵੀ ਉਹਨਾਂ ਇਤਿਹਾਸ 'ਚ ਕੀ ਕੀ ਹੈ ਅਤੇ ਕਿਹੜੇ ਕਿਹੜੇ ਗੁਰੂ ਸਾਹਿਬ ਦਾ ਯੋਗਦਾਨ ਸੀਗਾ ਜਿਵੇਂ ਕਿ ਉਹਨਾਂ ਨੂੰ ਦੱਸਿਆ ਜਾਊਗਾ ਵੀ ਕਿਵੇਂ ਚਾਲੀ ਮੁਕਤਿਆਂ ਨੇ ਇੱਥੇ ਆ ਕੇ ਸ਼ਹੀਦੀ ਪਾਈ ਅਤੇ ਕਿਵੇਂ ਦਸਵੇਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਮੁਕਤਸਰ ਸਾਹਿਬ ਦਾ ਨਾਮ ਖਿਦਰਾਣਾ ਤੋਂ ਮੁਕਤਸਰ ਸਾਹਿਬ ਰੱਖਿਆ ਠੀਕ ਹੈ ਅਤੇ ਹੋਰ ਵੀ ਉੱਥੇ ਕਈ ਥਾਵਾਂ ਹਨ ਜਿੱਥੇ ਉਹਨਾਂ ਨੂੰ ਲੈ ਕੇ ਜਾਇਆ ਜਾਊਗਾ ਅਤੇ ਉੱਥੋਂ ਹੋਰ ਹੋਰ ਹੋਰ ਐਕਟੀਵਿਟੀ ਕਰਵਾਈ ਜਾਣਗੀਆਂ ਅਤੇ ਉਹਨਾਂ ਨੂੰ ਉੱਥੇ ਵੀ ਲੈ ਕੇ ਜਾਇਆ ਜਾਊਗਾ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਖ ਖੰਜਰ ਖੁਭੋਇਆ ਸੀਗਾ ਅਤੇ ਉਹਨਾਂ ਦੇ ਇਤਿਹਾਸ ਬਾਰੇ ਵੀ ਦੱਸਾਂਗੇ ਵੀ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਨਾਂ ਨੇ ਉਹਨਾਂ ਦੇ ਇੱਕ ਜ਼ਹਿਰੀਲੇ ਖੰਜਰ ਨਾਲ ਸ਼ ਸ਼ਹੀਦੀ ਪ੍ਰਾਪਤ ਹੋਈ ਸੀਗੀ ਠੀਕ ਹੈ ਬਾਕੀ ਜੇ ਤੁਹਾਡਾ ਪੂਰਾ ਟਰੱਸਟ ਹੈਗਾ ਸਾਡੇ 'ਤੇ ਫਿਰ ਤਾਂ ਤੁਹਾਨੂੰ ਆਪਣੇ ਬੱਚੇ ਨੂੰ ਸਾਡੇ ਨਾਲ ਭੇਜਣਾ ਚਾਹੀਦਾ ਠੀਕ ਹੈ ਇਹਦੇ ਨਾਲ ਹੀ ਬੱਚੇ ਦੀ ਜਿਹੜੀ ਮਾਨਸਿਕ ਸਥਿਤੀ ਉਹ ਵੱਧਦੀ ਰਹਿੰਦੀ ਆ ਠੀਕ ਹੈ ਅਤੇ ਉਹਨੂੰ ਪੜ੍ਹਾਈ 'ਚ ਵੀ ਨਾਲ ਨਾਲ ਹੈਲਪ ਮਿਲੇਗੀ ਇਹ ਸਭ ਚੀਜ਼ਾਂ ਜਾਣ ਕੇ ਠੀਕ ਹੈ ਜੀ ਠੀਕ ਹੈ ਜੀ ਵੈਲਕਮ ਵੈਲਕਮ